ਭਾਰਤ ਵਿੱਚ ਉਦਯੋਗਪਤੀਆਂ ਲਈ ਸਹੂਲਤ ਲਈ ਵੱਖ ਵੱਖ ਸਕੀਮਾਂ ਚਲਾ ਚਲਾਈਆਂ ਜਾ ਰਹੀਆਂ ਉਹਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਰੁਜ਼ਗਾਰ ਸਿਮਰਨ ਯੋਜਨਾ ਤਹਿਤ ਬੇਰੁਜ਼ਗਾਰ ਯੋਜਨਾਵਾਂ ਨੂੰ ਨਵੇਂ ਉਦਯੋਗ ਸਥਾਪਿਤ ਕਰਨ ਤੋਂ ਇਲਾਵਾ ਘਰੇਲੂ ਉਦਯੋਗਾਂ ਨੂੰ ਸਥਾਪਿਤ ਕਰਨ ਲਈ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਸਕੀਮ ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣ ਯੋਜਨਾ ਤਹਿਤ ਬੈਂਕਾਂ ਦੇ ਕਰਜ਼ੇ ਦੀ ਸਹੂਲਤ ਪ੍ਰਾਪਤ ਹੈ ਇਸ ਸਕੀਮ ਅਧੀਨ ਕੁੱਲ ਪ੍ਰੋਜੈਕਟ ਲਗਾਤਾਰ ਉੱਪਰ ਪੰਦਰ੍ਹਾਂ ਪਰਸੇਂਟ ਤੋਂ ਪੈਂਤੀ ਪਰਸੇਂਟ ਤੱਕ ਸਬਸਿਡੀ ਦੀ ਸਹੂਲਤ ਦਿੱਤੀ ਜਾਂਦੀ ਆ ਇਹ ਸਕੀਮ ਆਨਲਾਈਨ ਆ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਲਘੂ ਫੂਡ ਪ੍ਰੋਸੈਸਇੰਗ ਇਕਾਈਆਂ ਸਕੀਮ ਤਹਿਤ ਜ਼ਿਲ੍ਹੇ ਵਿੱਚ ਪਹਿਲਾਂ ਤੋਂ ਹੀ ਚੱਲ ਰਹੇ ਫੂਡ ਪ੍ਰੋਸੈਸਿੰਗ ਯੂਨਿਟਾਂ ਦਾ ਵਿਸਥਾਰ ਕਰਨ ਲਈ ਕਰਜ਼ੇ ਦੀ ਸਹੂਲਤ ਪ੍ਰਾਪਤ ਆ ਇਹ ਸਕੀਮ ਬੈਂਕ ਰਾਹੀਂ ਮੁਹੱਈਆ ਕਰਵਾਈ ਜਾਂਦੀ ਹੈ ਇਹ ਸਕੀਮ ਅਧੀਨ ਕਰਜ਼ੇ ਦੀ ਹੱਦ ਇਕ ਕਰੋੜ ਰੁਪਏ ਅਤੇ ਪੈਂਤੀ ਪਰਸੇਂਟ ਵੱਧ ਤੋਂ ਵੱਧ ਦੱਸ ਲੱਖ ਰੁਪਏ ਜਾਂ ਕਿ ਕ੍ਰੈਡਿਟ ਲਿਮਿਟਡ ਕੈਪੀਟਲ ਸਬਸਿਡੀ ਤੌਰ 'ਤੇ ਪ੍ਰਾਪਤ ਕੀਤੀ ਜਾਂਦੀ ਆ ਇਸ ਵਿੱਚ ਪ੍ਰੋਜੈਕਟ ਲਾਗਤ ਦਾ ਦੱਸ ਪਰਸੇਂਟ ਸੰਬੰਧਿਤ ਉਮੀਦਵਾਰ ਵੱਲੋਂ ਪਾਇਆ ਜਾਂਦਾ ਹੈ ਉਹਨਾਂ ਦੱਸਿਆ ਪੰਜਾਬ ਸਰਕਾਰ ਵੱਲੋਂ ਨਵੀਂ ਉਦਯੋਗ ਨੀਤੀ ਦੋ ਹਜ਼ਾਰ ਸਤਾਰ੍ਹਾਂ ਤਹਿਤ ਨਵੇਂ ਉਦਯੋਗ ਚੱਲ ਰਹੇ ਉਦਯੋਗਾਂ ਦੇ ਪ੍ਰਸਾਰ ਤਹਿਤ ਅਨੇਕਾਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਉਦਯੋਗਾਂ ਨੂੰ ਪ੍ਰਫੁੱਲਤਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਦੋ ਹਜ਼ਾਰ ਸਤਾਰ੍ਹਾਂ ਵਿੱਚ ਇੰਡਸਟਰੀਅਲ ਪੋਲਿਸੀ ਤਹਿਤ ਉਦਯੋਗਾਂ ਨੂੰ ਸਹੂਲਤ ਅਤੇ ਬਿਜਨਸ ਫਸਟ ਪੋਰਟਲ ਲੌਂਚ ਕੀਤਾ ਜਾ ਰਿਹਾ ਸਕਿਲ ਡਿਵਲਪਮੈਂਟ ਵੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਜੋ ਕਿ ਪੀਐਮ ਵਿਕਾਸ ਕੋਸ਼ਲ ਯੋਜਨਾ ਦੇ ਅਧੀਨ ਆਉਂਦਾ ਹੈ ਇੱਥੇ ਕਈ ਤਰ੍ਹਾਂ ਦੇ ਨੌਜਵਾਨ ਜਾ ਕੇ ਆਪਣੇ ਸਕਿਲ ਡਿਵੈਲਪਮੈਂਟ ਕਰਦੇ ਹਨ ਅਤੇ ਉਹਨਾਂ ਦੇ ਅਨੁਸਾਰ ਹੀ ਉਹਨਾਂ ਨੂੰ ਨੌਕਰੀ 'ਤੇ ਵੀ ਮੁਹੱਈਆ ਨੌਕਰੀਆਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਇਸ ਲਈ ਪੰਜਾਬ ਦੀ ਬੇਰੁਜ਼ਗਾਰੀ ਕਾਫੀ ਹੱਦ 'ਤੇ ਘੱਟ ਰਹੀ ਹੈ ਉਦਯੋਗਾਂ ਵਿੱਚ ਉਦਯੋਗਪਤੀਆਂ ਨੂੰ ਆਪਣੇ ਉਦਯੋਗਾਂ ਸੰਬੰਧੀ ਕੋਈ ਵੀ ਕਲੀਅਰੈਂਸ ਲੈਣ ਲਈ ਆਨਲਾਈਨ ਅਪਲਾਈ ਕਰਨਾ ਹੁੰਦਾ ਹੈ ਅਤੇ ਆਨਲਾਈਨ ਉਹਨਾਂ ਨੂੰ ਕਲੀਅਰੈਂਸ ਮਿਲ ਜਾਂਦੀ ਆ ਇਸ ਪੋਲਸੀ ਤਹਿਤ ਨਵੇਂ ਉਦਯੋਗ ਚੱਲ ਰਹੇ ਉਦਯੋਗਾਂ ਦੇ ਪਸਾਰ ਵਿੱਚ ਹੇਠ ਕਈ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਇਹਨਾਂ ਸਹੂਲਤਾਂ ਵਿੱਚ ਜਿਵੇਂ ਕਿ ਸਬਸਿਡੀ ਦਿੱਤੀ ਜਾਂਦੀ ਹੈ ਪੰਜ ਪਰਸੇਂਟ ਤੋਂ ਛੋਟ ਦਿੱਤੀ ਜਾਂਦੀ ਹੈ ਕਰਜ਼ੇ ਉੱਪਰ ਵਿਆਜ ਦਰ ਪੰਜ ਪਰਸੰਟ ਦੀ ਛੋਟ ਆਦਿ ਸ਼ਾਮਿਲ ਆ ਹੁਣ ਇਸ ਵਿੱਚ ਵਧੀਕ ਰਜਿਸਟਰਾਰ ਅਤੇ ਸੋਸਾਇਟੀ ਜ਼ਿਲ੍ਹਾ ਸੋਸਾਇਟੀ ਜ਼ਿਲ੍ਹਾ ਤਰਨ ਤਾਰਨ ਦੇ ਤੌਰ 'ਤੇ ਇਸ ਦਫਤਰ ਵੱਲੋਂ ਇਸ ਜ਼ਿਲ੍ਹੇ ਨਾਲ ਸੰਬੰਧਿਤ ਸੋਸਾਇਟੀਆਂ ਨੂੰ ਸੁਸਾਇਟੀਜ਼ ਐਕਟ ਅਠਾਰ੍ਹਾਂ ਸੌ ਸੱਠ ਅਧੀਨ ਰਜਿਸਟਰ ਕੀਤਾ ਜ ਗਿਆ ਇਹ ਰਜਿਸਟਰੇਸ਼ਨ ਦੋ ਹਜ਼ਾਰ ਵੀਹ ਤੱਕ ਉਦਯੋਗਪਤੀਆਂ ਆਪਣੇ ਉਦਯੋਗ ਵੱਖ ਵੱਖ ਪੂਰਨ ਪ੍ਰਵਾਨਗੀਆਂ ਲੈਣ ਤੋਂ ਪਹਿਲਾਂ ਸ਼ੁਰੂ ਕਰਨ ਦਿੱਤੀ ਗਈ ਇਸ ਐਕਟ ਅਧੀਨ ਉਦਯੋਗਪਤੀ ਆਪਣੇ ਕਾਰੋਬਾਰ ਨੂੰ ਸ਼ੁਰੂ ਕਰਨ ਤੋਂ ਬਾਅਦ ਤਿੰਨ ਸਾਲ ਛੇ ਮਹੀਨੇ ਦੇ ਸਮੇਂ ਅੰਦਰ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਕਰ ਸਕਦੇ ਆ ਪਹਿਲਾਂ ਉਦਯੋਗਪਤੀਆਂ ਨੂੰ ਆਪਣੇ ਪਰਚੇਸ ਦੇ ਬਿੱਲ ਵਗੈਰਾ ਸ਼ੋਅ ਕਰਨੇ ਪੈਂਦੇ ਆ ਬੈਂਕ ਨੂੰ ਜਾ ਕੇ ਅਤੇ ਕਰੰਟ ਅਕਾਊਂਟ ਓਪਨ ਕਰਨਾ ਪੈਂਦਾ ਅਤੇ ਆਪਣੀ ਟਰਾਂਜੈਕਸ਼ਨ ਹਿਸਟਰੀ ਬੈਂਕ ਅੱਗੇ ਪੇਸ਼ ਕਰਨੀ ਪੈਂਦੀ ਹੈ ਜਿਸ ਤੋਂ ਉਪਰੰਤ ਬੈਂਕ ਸਾਰੀਆਂ ਪ੍ਰਵੇਲਜੀਜ ਦੇਖ ਕੇ ਉਹਨਾਂ ਦਾ ਲੋਨ ਪਾਸ ਕਰਦਾ ਹੈ ਉਕੱਤ ਸਕੀਮ ਦੀ ਵਧੇਰੇ ਜਾਣਕਾਰੀ ਲਈ ਦਫਤਰ ਜਨਰਲ ਮੈਜ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਕੋਲ ਜਾ ਕੇ ਪਤਾ ਕੀਤਾ ਜਾਂਦਾ ਹੈ